ਮੇਰੇ ਲਈ ਸਭ ਤੋਂ ਚੁਣੌਤੀਪੂਰਨ ਵਿਅੰਜਨ ਮੇਰੀ ਆ ਸਟੱਡੀ ਦੇ ਵਿੱਚ ਜੇ ਆਰ ਐਫ ਦਾ ਪੇਪਰ ਸੀ ਜਿਸ ਨੂੰ ਮੈਂ ਪੂਰਾ ਕਰਨ ਲਈ ਬਹੁਤ ਵਾਰ ਕੋਸ਼ਿਸ਼ ਕੀਤੀ ਕੋਸ਼ਿਸ਼ ਕਰਦੇ ਰਹੇ ਪਰ ਕੋਸ਼ਿਸ਼ ਕਰਦੇ ਕਰਦੇ ਜਿਹੜਾ ਉਹਦੇ ਵਿੱਚ ਅਨੁਭਵ ਹੋਇਆ ਉਹ ਤੋਂ ਮੈਂ ਬਹੁਤ ਕੁਝ ਨਾਲ ਨਾਲ ਸਿੱਖੀ ਵੀ ਗਿਆ ਜਿੰਨੀ ਵਾਰੀ ਜਿਹੜਾ ਪੇਪਰ ਆ ਉਹ ਨਹੀਂ ਕੰਪਲੀਟ ਹੋਇਆ ਤਾਂ ਉਹਦੇ ਵਿੱਚ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਸੀ ਕਿ ਕਿਉਂ ਨਹੀਂ ਹੋਇਆ ਤਾਂ ਜਦੋਂ ਅਗਲੀ ਵਾਰ ਉਹ ਪੇਪਰ ਦਿੰਦੇ ਸੀ ਤਾਂ ਉਸ ਨੂੰ ਉਸ 'ਤੇ ਜਿਹੜਾ ਪਿਛਲੀ ਵਾਰ ਜਿਹੜੀਆਂ ਕਮਜ਼ੋਰੀਆਂ ਰਹਿ ਜਾਂਦੀਆਂ ਸੀ ਉਹਨਾਂ 'ਤੇ ਫੋਕਸ ਕਰਨ ਦੀ ਜਾਂ ਉਹਨਾਂ ਨੂੰ ਸੋਲਵ ਕਰਨ ਦੀ ਜ਼ਿਆਦਾ ਕੋਸ਼ਿਸ਼ ਕੀਤੀ ਜਾਂਦੀ ਸੀ ਤਾਂ ਇਹ ਲਗਾਤਾਰ ਸਿੱਖਦੇ ਰਹੇ ਅਤੇ ਇਹਨਾਂ ਜਿਹੜੀਆਂ ਇਸ ਚੁਣੌਤੀ ਨੂੰ ਜਿਹੜਾ ਹੌਲੀ ਹੌਲੀ ਪੂਰਾ ਕਰਦੇ ਰਹੇ ਪਰ ਅੰਤ ਵਿੱਚ ਆ ਕੇ ਚੁਣੌਤੀ ਜਿਹੜੀ ਮੈਂ ਆਪਣੀ ਉਹ ਪੂਰੀ ਕਰ ਲਈ ਜਿਹੜਾ ਉਹਦੇ ਵਿੱਚੋਂ ਅਨੁਭਵ ਸੀ ਉਹਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਇੱਕ ਤਾਂ ਇਹ ਕਿ ਕਦੇ ਵੀ ਜਿਹੜੀ ਉਹ ਹਿੰਮਤ ਨਹੀਂ ਹਾਰਨੀ ਚਾਹੀਦੀ ਸਾਨੂੰ ਲਗਾਤਾਰ ਜਿਹੜਾ ਅਸੀਂ ਟਾਸਕ ਚੁਣਿਆ ਜਿਹੜਾ ਵਿਅੰਜਨ ਸਾਡੇ ਲਈ ਹੈਗਾ ਉਹਦੇ ਲਈ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਤਾਂ ਉਹਦੇ ਵਿੱਚ ਸਾਨੂੰ ਜਿਹੜੀ ਉਹ ਹੌਲੀ ਹੌਲੀ ਅੱਗੇ ਜਿਹੜੀ ਕਾਮਯਾਬੀ ਉਹ ਮਿਲ ਜਾਂਦੀ ਆ ਦੂਜਾ ਇਹ ਸੀ ਕਿ ਕਈ ਵਾਰੀ ਅਸੀਂ ਜਦੋਂ ਤਿਆਰੀ ਕਰਦੇ ਹਾਂ ਕਿਸੇ ਵਿਸ਼ੇ ਦੀ ਤਿਆਰੀ ਕਰਦੇ ਹਾਂ ਤਾਂ ਸਾਨੂੰ ਕੁਛ ਚੀਜ਼ਾਂ ਸਾਡੀਆਂ ਉਹਦੇ ਵਿੱਚ ਕਮਜ਼ੋਰ ਹੁੰਦੀਆਂ ਨੇ ਤਾਂ ਸਾਨੂੰ ਕਮਜ਼ੋਰ ਵੱਲ ਜ਼ਿਆਦਾ ਧਿਆਨ ਨਾ ਦੇ ਕੇ ਅਸੀਂ ਜਿਨ੍ਹਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਡੇ ਲਈ ਚੰਗੀਆਂ ਨੇ ਪੇਪਰ ਦੇ ਵਿੱਚ ਉਹਨਾਂ 'ਤੇ ਅਸੀਂ ਜ਼ਿਆਦਾ ਧਿਆਨ ਦੇ ਸਕਦੇ ਹਾਂ ਤਾਂ ਉਹਨਾਂ 'ਤੇ ਜ਼ਿਆਦਾ ਧਿਆਨ ਦੇ ਕੇ ਵੀ ਜਿਹੜਾ ਅਸੀਂ ਆਪਣਾ ਟਾਸਕ ਕੰਪਲੀਟ ਕਰ ਸਕਦੇ ਹਾਂ ਕਮਜ਼ੋਰ ਕੜੀਆਂ ਜਿਹੜੀਆਂ ਸਾਡੀਆਂ ਉਹਨਾਂ ਨੂੰ ਅਸੀਂ ਜੇਕਰ ਉਹ ਓਨੀਆਂ ਮਹੱਤਵਪੂਰਨ ਨਹੀਂ ਹੈਗੀਆਂ ਸਾਨੂੰ ਵਿਸ਼ੇ ਨੂੰ ਪਾਸ ਕਰਵਾਉਣ ਲਈ ਤਾਂ ਉਹਨੂੰ ਅਸੀਂ ਛੱਡ ਵੀ ਸਕਦੇ ਹਾਂ ਜਿਵੇਂ ਇਹਦੇ ਵਿੱਚ ਦੋ ਪੇਪਰ ਆ ਫਸਟ ਪੇਪਰ ਔਰ ਸੈਕਿੰਡ ਪੇਪਰ ਤਾਂ ਅਸੀਂ ਵਿਸ਼ੇ ਵਾਲੇ ਪੇਪਰ 'ਚੋਂ ਕਈ ਵਾਰੀ ਜ਼ਿਆਦਾ ਨੰਬਰ ਲਿਜਾ ਸਕਦੇ ਹਾਂ ਉਹ ਸਾਨੂੰ ਦੇਖਣਾ ਪੈਂਦਾ ਕਈ ਵਾਰੀ ਕਿ ਟਾਸਕ ਸਾਡਾ ਕਿੱਦਾਂ ਦਾ ਹੈ ਕਿਹੜੀ ਚੀਜ਼ 'ਤੇ ਜ਼ਿਆਦਾ ਧਿਆਨ ਦਿੱਤਾ ਜਾ ਸਕਦਾ